ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤਿੰਨ ਜਾਂ ਚਾਰ ਤਰ੍ਹਾਂ ਦੇ ਅਲਗ ਅਲਗ ਗਰੁੱਪ ਰਹਿੰਦੇ ਨੇ ਇਹਨਾਂ ਦੇ ਜਿਹੜੇ ਗਰੁੱਪ ਹੈਗੇ ਨੇ ਇਹਦੇ ਵਿੱਚ ਬਿਰਾਦਰੀਆਂ ਨੇ ਜਿਵੇਂ ਰਾਜ ਸਿੱਖ ਬਿਰਾਦਰੀ ਹੋਈ ਸਿੱਖ ਬਿਰਾਦਰੀ ਹੈਗੀ ਹੈ ਜੱਟ ਸਿੱਖ ਬਿਰਾਦਰੀ ਹੈਗੀ ਹੈ ਕੰਬੋਜ ਬਿਰਾਦਰੀ ਏ ਅਡੋ ਅਰੋੜਾ ਬਿਰਾਦਰੀ ਏ ਅਤੇ ਕੁਛ ਏਰੀਆ ਜਿਹੜਾ ਆਸ ਪਾਸ ਦਾ ਹੈਗਾ ਹੈ ਉਹ ਆਪਣੇ ਬਾਗੜੀ ਬਿਰਾਦਰੀ ਦੇ ਲੋਕ ਰਹਿੰਦੇ ਨੇ ਅਤੇ ਸਾਰੀਆਂ ਹੀ ਬਿਰਾਦਰੀਆਂ ਜਿਹੜੇ ਹੈਗੇ ਨੇ ਮੇਨ ਫ ਪੰਜਾਬੀ ਬੋਲਦੀਆਂ ਨੇ ਕੁਛ ਕੁਛ ਭਾਸ਼ਾਵਾਂ ਜਿਹੜੀ ਹੈਗੀਆਂ ਨੇ ਉਹ ਉਹਨਾਂ 'ਤੇ ਬਾਗੜੀ ਏਰੀਏ ਦੇ ਵਿੱਚ ਰਾਜਸਥਾਨੀ ਭਾਸ਼ਾ ਦਾ ਪ੍ਰਭਾਵ ਨਜ਼ਰ ਆਉਂਦਾ ਹੈ ਜਦ ਕਿ ਸ਼ਹਿਰੀ ਏਰੀਏ ਦੇ ਵਿੱਚ ਪੰਜਾਬੀ ਪ੍ਰੋਪਰ ਬੋਲੀ ਜਾਂਦੀ ਏ ਅਤੇ ਜਿਹੜਾ ਬਾਰਡਰ ਦਾ ਏਰੀਆ ਹੈ ਉਸ ਏਰੀਏ ਦੇ ਵਿੱਚ ਜ਼ਿਆਦਾਤਰ ਪਾਕਿਸਤਾਨੀ ਭਾਸ਼ਾ ਦਾ ਵੀ ਪ੍ਰਭਾਵ ਨਜ਼ਰ ਆਉਂਦਾ ਹੈ ਬਾਕੀ ਸਾਰੇ ਜਾ ਕਲਚਰ ਜਿਹੜਾ ਹੈਗਾ ਉਹ ਸਬ ਜਣਿਆਂ ਦਾ ਲਗਭਗ ਇੱਕੋ ਜਿਹਾ ਹੈ ਅਤੇ ਸਭ ਜਣੇ ਮਿਲ ਜੁਲ ਕੇ ਹੀ ਰਹਿੰਦੇ ਨੇ